ਪੰਜਾਬੀ ਸਾਹਿਤ ਦੀ ਗਹਿਰੀ ਪਰੰਪਰਾ ਨੇ ਮੇਰੀ ਲਿਖਤ ਨੂੰ ਬਹੁਤ ਪ੍ਰਭਾਵਿਤ ਕੀਤਾ ਪੰਜਾਬੀ ਸਾਹਿਤ ਦੀ ਵਿਅਕਤੀਗਤ ਅਤੇ ਲੋਕ ਧਾਰਾ ਨਾਲ ਜੁੜੀ ਅਨੁਭੂਤੀਆਂ ਭਾਵਨਾਵਾਂ ਅਤੇ ਅੰਦਰੂਨੀ ਗਹਿਰਾਈਆਂ ਨੇ ਮੈਨੂੰ ਆਪਣੇ ਸ਼ਬਦਾਂ ਵਿੱਚ ਖਰੇ ਭਾਗ ਪੇਸ਼ ਕਰਨ ਦੀ ਸਿੱਖ ਦਿੱਤੀ ਹੈ ਪੰਜਾਬੀ ਸਾਹਿਤ ਵਿੱਚ ਰੂਹਾਨੀਅਤ ਪ੍ਰੇਮ ਵਿਛੋੜਾ ਬਗਾਵਤ ਅਤੇ ਸਮਾਜਿਕ ਯਥਾਰਥ ਵਰਗੇ ਵਿਸ਼ਿਆਂ ਦੀ ਵਿਆਪਕ ਝਲਕ ਮਿਲਦੀ ਹੈ ਜੋ ਮੇਰੀ ਲਿਖਤ ਵਿੱਚ ਝਲਕਦੀ ਹੈ ਕੁਝ ਵਿਸ਼ੇਸ਼ ਪੰਜਾਬੀ ਲੇਖਕ ਅਤੇ ਕਵੀ ਜਿਹਨਾਂ ਨੇ ਮੈਨੂੰ ਪ੍ਰਭਾਵ ਜਿਹਨਾਂ ਨੇ ਪ੍ਰਭਾਵ ਪਾਇਆ ਉਹ ਹਨ ਰੀ ਹੀਰ ਰਾਂਝਾ ਵਾਰਿਸ ਸ਼ਾਹ ਨੇ ਸਿਰਫ ਇੱਕ ਪ੍ਰੇਮ ਕਹਾਣੀ ਲਿਖੀ ਬਲਕਿ ਉਹਨਾਂ ਨੇ ਸਮਾਜ ਦੀ ਅਸਲ ਸੱਚਾਈ ਦੁਨੀਆ 'ਤੇ ਮਹਿਲਾਵਾਂ ਦੀ ਸਥਿਤੀ ਨੂੰ ਵੀ ਦਰਸਾਇਆ ਉਹਨਾਂ ਦੀ ਕਾਵਿ ਵਿੱਚ ਦਿਲ ਦੀ ਗਹਿਰਾਈ ਅਤੇ ਜ਼ਿੰਦਗੀ ਦੀ ਨਿਮਰਤਾ ਬਹੁਤ ਗਹਿਰੀ ਹੈ ਜੋ ਮੇਰੀ ਲਿਖਤ ਵਿੱਚ ਵਿਛੋੜੇ ਦੁੱਖ ਅਤੇ ਪ੍ਰੇਮ ਦੀ ਅਭਿ ਯਕਤੀ ਚਾਹੁੰਦੀ ਹੈ ਸ਼ਿਵ ਕੁਮਾਰ ਬਟਾਲਵੀ ਵਿਛੋੜਾ ਅਤੇ ਦੁੱਖ ਦੀ ਪਿਆਸ ਲੂਣਾ ਪੰਜਾਬੀ ਸਾਹਿਤ ਦੀ ਸਭ ਤੋਂ ਪ੍ਰਸਿੱਧ ਕਾਵਿ ਨਾਟਕ ਉਹਨਾਂ ਦੀ ਕਵੀ ਨੇ ਦਿਲ ਦੇ ਗਹਿਰੇ ਦੁੱਖ ਵਿਛੋੜੇ ਅਤੇ ਪਿਆਰ ਦੀ ਬੇਵੱਸੀ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਇਆ